ਅਸੀਂ ਫੂਡ ਔਡਰਿੰਗ ਐਪਾਂ ਨੂੰ ਘੱਟ ਇਸਤੇਮਾਲ ਕਰਦੇ ਹਾਂ ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਉਹ ਤੋਂ ਮੰਗਵਾ ਸਕਦੇ ਹਾਂ ਉਹੀ ਸਾਨੂੰ ਬਜ਼ਾਰੋਂ ਮਿਲ ਜਾਂਦੀਆਂ ਹਨ ਅਤੇ ਉਹਦੀ ਵਿਸ਼ੇਸ਼ਤਾਵਾਂ ਇਹ ਵੀ ਨੇ ਕਿ ਅਸੀਂ ਘਰ ਬੈਠਿਆਂ ਉਹ ਚੀਜ਼ਾਂ ਨੂੰ ਪਾ ਸਕਦੇ ਹਾਂ ਲੈਣ ਨੂੰ ਕੋਈ ਦਿੱਕਤ ਨਹੀਂ ਹੈ ਲੈ ਵੀ ਸਕਦੇ ਹਾਂ ਅਤੇ ਮੈਂ ਤਾਂ ਇਸ ਐਪ ਦੀ ਘੱਟ ਵਰਤੋਂ ਘੱਟ ਕਰਦੀ ਹਾਂ ਅਤੇ ਜਿੱਥੇ ਵੀ ਕੀਤੀ ਹੈ ਕਿ ਮੀਸ਼ੋ ਐਪ ਵਗੈਰਾ ਹੈਗੇ ਨੇ ਉਹਨਾਂ ਦੀ ਐਪ 'ਤੇ ਮੈਂ ਜਿੰਨੀ ਵੀ ਵਰਤੋਂ ਕੀਤੀ ਹੈ ਅਤੇ ਬਹੁਤ ਵਧੀਆ ਰਹੀ ਹੈ